ਗਲਾ ਠੀਕ ਕਰਨ ਲਈ ਸਾਡੇ ਪਿੰਡ ਵਿੱਚ ਘਰੇਲੂ ਉਪਚਾਰ ਇਹ ਹਨ ਕਿ ਸਾਨੂੰ ਇੱਕ ਕੋਈ ਵੀ ਫਰਾਈ ਪੈਨ ਲੈ ਕੇ ਉਸ ਵਿੱਚ ਪਾ ਗਰਮ ਪਾਣੀ ਕਰਨਾ ਚਾਹੀਦਾ ਹੈ ਅਤੇ ਉਸ ਵਿੱਚ ਥੋੜ੍ਹਾ ਜਿਹਾ ਨਮਕ ਪਾ ਕੇ ਸਾਨੂੰ ਗਰਾਰੇ ਕਰਨੇ ਚਾਹੀਦੇ ਹਨ ਜਿਸ ਕਾਰਨ ਨਾਲ ਸਾਡਾ ਗਲਾ ਠੀਕ ਹੋ ਸਕਦਾ ਹੈ ਇਹ ਕੰਮ ਸਾਨੂੰ ਦਿਨ ਵਿੱਚ ਕੋਈ ਤਿੰਨ ਚਾਰ ਵਾਰ ਕਰਨਾ ਚਾਹੀਦਾ ਹੈ ਇਸ ਨਾਲ ਸਾਡੇ ਗਲੇ ਨੂੰ ਆਰਾਮ ਮਿਲਦਾ ਹੈ ਬਾਕੀ ਜੇਕਰ ਅਸੀਂ ਹੋਰ ਕੁਝ ਕਰਨਾ ਚਾਹੁੰਦੇ ਹਾਂ ਤਾਂ ਉਹ ਇਹ ਹੈ ਕਿ ਸਾਨੂੰ ਥੋੜ੍ਹਾ ਜਿਹਾ ਅਦਰਕ ਅਤੇ ਥੋੜ੍ਹੀ ਜਿਹੀ ਇਲਾਚੀ ਲੈ ਕੇ ਉਸ ਦੀ ਚਾਹ ਬਣਾਉਣੀ ਚਾਹੀਦੀ ਹੈ ਜੋ ਕਿ ਚਾਹ ਪੀਣ ਨਾਲ ਵੀ ਗਲਾ ਥੋੜ੍ਹਾ ਠੀਕ ਹੋ ਸਕਦਾ ਹੈ ਇਹ ਕੰਮ ਵੀ ਸਾਨੂੰ ਦਿਨ ਵਿੱਚ ਇੱਕ ਦੋ ਵਾਰ ਕਰ ਲੈਣਾ ਚਾਹੀਦਾ ਹੈ ਜਿਸ ਕਾਰਨ ਸਾਡਾ ਗਲਾ ਠੀਕ ਹੋ ਸਕਦਾ ਹੈ